ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ

ਅੱਛਾ ਜੀ ਕੋਈ ਗੱਲ ਨਹੀਂ ਜੀ ਮੈਂ ਤੁਹਾਡੀ ਪੜੋਸੀ ਹੋਈ ਹਾਂ ਮੈਂ ਤੁਹਾਨੂੰ ਦੱਸਦੀ ਹਾਂ ਆਪਣੇ ਘਰ ਦੇ ਅੱਗੇ ਇੱਕ ਰੇੜੀ ਆਉਂਦੀ ਨੇ ਉਹ ਵੀ ਬੜੀ ਵਧੀਆ ਸਬਜ਼ੀ ਲੈ ਕੇ ਆਉਂਦੀ ਹੈ ਅਤੇ ਉਹ ਸਬਜ਼ੀ ਵੀ ਤਾਜ਼ੀ ਹੁੰਦੀ ਹੈ ਕਿਤੇ ਕਿਤੇ ਹੀ ਉਹਦੀ ਵੇਹੀ ਹੁੰਦੀ ਹੈ ਤੁਸੀਂ ਦੱਸੋ ਇੱਥੋਂ ਲੈਣੀ ਹੈ ਜਾਂ ਤੁਸੀਂ ਸਵੇਰੇ ਸਵੇਰੇ ਆਪਣੇ ਮੁਕਤਸਰ ਸ਼ਹਿਰ ਦੇ ਵਿੱਚ ਇੱਕ ਮੰਡੀ ਲੱਗਦੀ ਹੈ ਦਾਣਾ ਮੰਡੀ ਵੀ ਹੈ ਅਤੇ ਨਵੀਂ ਮੰਡੀ ਵੀ ਹੈ ਅਤੇ ਇੱਕ ਆਪਣੇ ਫਾਟਕਾਂ ਕੋਲ ਵੀ ਮੰਡੀ ਲੱਗਦੀ ਹੈ ਆਪਾਂ ਬ ਸ਼ਾਮ ਦੇ ਟਾਈਮ ਉਥੋਂ ਸਸਤੀ ਸਬਜ਼ੀ ਵੀ ਲਿਆ ਕਰਾਂਗੇ ਅਤੇ ਨਾਲੇ ਉਹ ਸਬਜ਼ੀ ਵੀ ਵਧੀਆ ਹੁੰਦੀ ਹੈ ਜਿਹੜਾ ਆਪਣੇ ਇੱਥੇ ਸਾਹਮਣੇ ਘਰ ਭਾਈ ਆਉਂਦਾ ਨੇ ਰੇਹੜੀ 'ਤੇ ਉਹ ਥੋੜ੍ਹੀ ਮਹਿੰਗੀ ਹੁੰਦੀ ਸਬਜ਼ੀ ਉਹਦੀ ਪਰ ਹੁੰਦੀ ਉਹਦੀ ਵੀ ਵਧੀਆ ਨੇ ਕਈ ਵਾਰ ਤਾਂ ਐਂ ਹੁੰਦਾ ਨਹੀਂ ਆਪਾਂ ਬਾਜ਼ਾਰ ਗਏ ਹਾਂ ਤਾਂ ਆਪਾਂ ਬਾਜ਼ਾਰੋਂ ਵੀ ਲਿਆਉਂਦੇ ਹੁੰਦੇ ਹਾਂ ਸਬਜ਼ੀ ਅਤੇ ਕੋਈ ਗੱਲ ਨਹੀਂ ਤੁਸੀਂ ਮੈਨੂੰ ਦੱਸਿਓ ਮੈਂ ਤੁਹਾਡੇ ਨਾਲ ਜਦੋਂ ਵੀ ਜਾਣਾ ਹੋਇਆ ਤਾਂ ਮੈਂ ਤੁਹਾਡੇ ਨਾਲ ਚੱਲ ਵੜੂੰਗੀ ਅਤੇ ਸਬਜ਼ੀ ਲੈਣ ਵਾਸਤੇ ਅਗਰ ਮੰਡੀ 'ਚੋਂ ਲੈ ਕੇ ਆਉਣੀ ਹੈ ਤਾਂ ਤੁਸੀਂ ਮੇਰੇ ਨਾਲ ਸ਼ਾਮ ਦੇ ਟਾਈਮ ਮੰਡੀ 'ਤੇ ਚਲੇ ਜਾਓ ਜਾਂ ਸੁਬਹਾ ਸੁਬਹਾ ਜਲਦੀ ਸਸਤੀ ਲਿਆਵਾਂਗੇ ਤਾਂ ਫਿਰ ਖੇਤਾਂ 'ਚੋਂ ਆਈ ਹੁੰਦੀ ਉਦੋਂ ਤਾਜ਼ੀ ਸਬਜ਼ੀ ਮਿਲ ਜਾਂਦੀ ਆ ਆਪਾਂ ਨੂੰ ਆਪਾਂ ਉਦੋਂ ਚੱਲ ਵੜਾਂਗੇ ਜੇ ਤੁਸੀਂ ਹੁਣ ਲੈਣੀ ਹੈ ਤਾਂ ਹੁਣ ਤਾਂ ਟਾਈਮ ਵੀ ਕਾਫ਼ੀ ਹੋ ਗਿਆ ਹੁਣ ਤਾਂ ਆਪਣੀ ਬਾਅਦ 'ਚ ਰੇਹੜੀ ਹੋਣ ਵਾਲੀ ਹੈਗੀ ਆ ਆਪਾਂ ਉਹ ਤੋਂ ਲੈ ਲੈਂਦੇ ਹਾਂ ਉਹਦੀ ਸਬਜ਼ੀ ਵਧੀਆ ਹੁੰਦੀ ਥੋੜ੍ਹੀ ਹੀ ਮਹਿੰਗੀ ਹੁੰਦੀ ਹੈ ਅਤੇ ਜੇ ਸਸਤੀ ਲੈਣੀ ਤਾਂ ਫਿਰ ਆਪਾਂ ਸ਼ਾਮ ਨੂੰ ਲੈ ਆਵਾਂਗੇ ਤੁਸੀਂ ਦੱਸੋ ਤੁਹਾਨੂੰ ਜਿਵੇਂ ਠੀਕ ਲੱਗਦਾ ਆਪਾਂ ਸ਼ਾਮ ਨੂੰ ਚੱਲਦਾ ਤਾਂ ਸ਼ਾਮ ਨੂੰ ਚੱਲ ਵੜਾਂਗੇ ਹਾਂਜੀ ਕੋਈ ਗੱਲ ਨਹੀਂ ਜੀ ਉਹ ਆਪਾਂ ਮੰਡੀ 'ਚੋਂ ਲੈ ਆਵਾਂਗੇ ਮੰਡੀ ਦੇ ਵਿੱਚ ਵੀ ਬੜੀ ਸਸਤੀ ਸਬਜ਼ੀ ਮਿਲਦੀ ਹੈ ਅਤੇ ਰੈਡ ਕਰੋਸ ਵਾਲੀ ਵੀ ਆਪਣੇ ਇੱਧਰ ਲੱਗੀਆਂ ਹੁੰਦੀਆਂ ਨੇ ਰੇਹੜੀਆਂ ਕਾਫ਼ੀ ਉੱਥੇ ਵੀ ਕਾਫ਼ੀ ਵਧੀਆ ਸਸਤੀ ਸਬਜ਼ੀ ਮਿਲ ਜਾਂਦੀ ਨਾਲ ਸਬਜ਼ੀ ਵੀ ਫਰੈਸ਼ ਹੁੰਦੀ ਹੈ ਅਤੇ ਨਾਲ ਬਹੁਤ ਵਧੀਆ ਸਬਜ਼ੀ ਮਿਲਦੀ ਨੇ ਅਤੇ ਆਪਣੇ ਜਿਹੜੇ ਇੱਧਰ ਹੈਗੇ ਨੇ ਦਾਣਾ ਮੰਡੀ ਹੈ ਉੱਥੇ ਵੀ ਵਧੀਆ ਸਬਜ਼ੀ ਮਿਲਦੀ ਹੈ ਸ਼ਾਮ ਦੇ ਟਾਈਮ ਵੀ ਕਾਫ਼ੀ ਵਧੀਆ ਸਬਜ਼ੀ ਹੁੰਦੀ ਹੈ ਲੋਕ ਦੂਰੋਂ ਦੂਰੋਂ ਵੀ ਇੱਥੋਂ ਲੈ ਕੇ ਜਾਂਦੇ ਨੇ ਤੁਹਾਨੂੰ ਜਿੱਦਾਂ ਠੀਕ ਲੱਗਦਾ ਆਪਾਂ ਉਵੇਂ ਕਰ ਲਾਂਗੇ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਚੱਲ ਵੜੂੰਗੀ ਅਤੇ ਦੇਖ ਲਿਓ ਵੈਸੇ ਜੇ ਤੁਹਾਨੂੰ ਹੁਣ ਜਲਦੀ ਹੈ ਤਾਂ ਵੀ ਹੁਣ ਅਗਰ ਤੁਸੀਂ ਬਣਾਉਣੀ ਹੈ ਅਗਰ ਨਹੀਂ ਹੈ ਤਾਂ ਤੁਸੀਂ ਆਪਣੇ ਗੇਟ 'ਚ ਆਉਂਦਾ ਨੇ ਇੱਕ ਭਾਈ ਅਤੇ ਉਹਦੀ ਸਬਜ਼ੀ ਵੀ ਠੀਕ ਹੁੰਦੀ ਕਿਤੇ ਕਿਤੇ ਉਹ ਬੇਹੀ ਸਬਜ਼ੀ ਲਿਆਉਂਦਾ ਨਹੀਂ ਨਹੀਂ ਤਾਂ ਵੈਸੇ ਜ਼ਿਆਦਾਤਰ ਉਹਦੀ ਵੀ ਸਬਜ਼ੀ ਵਧੀਆ ਹੁੰਦੀ ਹੈ ਅਤੇ ਉਹਦੇ ਕੋਲੋਂ ਲੈ ਕੇ ਦੇਖ ਲਿਓ ਇੱਕ ਵਾਰੀ ਜੇ ਤੁਹਾਨੂੰ ਜਚਿਆ ਤਾਂ ਵੀ ਆਪਾਂ ਇੱਕ ਵਾਰੀ ਇੱਥੋਂ ਲੈ ਲੈਂਦੇ ਹਾਂ ਅਤੇ ਸ਼ਾਮ ਨੂੰ ਮੈਂ ਫਰੀ ਹੋਉਂਗੀ ਤਾਂ ਫਿਰ ਮੈਂ ਦੇਖ ਲਉਂਗੀ ਤੁਹਾਡੇ ਨਾਲ ਸ਼ਾਮ ਨੂੰ ਚੱਲ ਵੜੂੰਗੀ ਅਤੇ ਆਪਾਂ ਉੱਥੋਂ ਲੈ ਆਵਾਂਗੇ ਮੰਡੀ ਤੋਂ ਲੈ ਆਵਾਂਗੇ ਨਹੀਂ ਤਾਂ ਆਪਾਂ ਰੈਡ ਕਰੋਸ ਕੋਲੋਂ ਲੈ ਆਵਾਂਗੇ ਰੈਡ ਕਰਾਸ ਵਾਲੀ ਵੀ ਬਹੁਤ ਵਧੀਆ ਸਬਜ਼ੀ ਮਿਲਦੀ ਹੈ ਅਤੇ ਜਾਂ ਇੱਧਰ ਵੀ ਦੇਖ ਲਵਾਂਗੇ ਨਹੀਂ ਤਾਂ ਜਿਹੜੀ ਦਾਣਾ ਮੰਡੀ ਨਹੀਂ ਅਤੇ ਇੱਥੇ ਵੀ ਕਾਫ਼ੀ ਵਧੀਆ ਮਿਲ ਜਾਂਦੀ ਸਬਜ਼ੀ ਜਿੱਦਾਂ ਤੁਹਾਨੂੰ ਠੀਕ ਲੱਗਦਾ ਫਿਰ ਆਪਾਂ ਉਵੇਂ ਕਰ ਲਾਂਗੇ ਜੇ ਅਗਰ ਤੁਸੀਂ ਹੁਣ ਨਹੀਂ ਬਣਾਉਣੀ ਤਾਂ ਆਪਾਂ ਸ਼ਾਮ ਨੂੰ ਚੱਲ ਵੜਦੇ ਫਿਰ ਸ਼ਾਮ ਨੂੰ ਲੈ ਆਉਂਦੇ ਹਾਂ ਸਬਜ਼ੀ ਹਾਂਜੀ ਕੋਈ ਗੱਲ ਨਹੀਂ ਠੀਕ ਹੈ ਜੀ ਮੈਂ ਫਿਰ ਚੱਲ ਵੜੂੰਗੀ ਤੁਹਾਡੇ ਨਾਲ ਹਾਂਜੀ ਹਾਂਜੀ ਕੋਈ ਗੱਲ ਨਹੀਂ ਜੀ ਆਵਾਂਗੇ ਠੀਕ ਹੈ ਜੀ